ਜੇ ਅੱਜ ਦੇ ਵਿਆਹ ਦੇ ਕ ਕਲਚਰ ਨੂੰ ਦੇਖੀਏ ਅਤੇ ਪੁਰਾਣੇ ਸਮੇਂ ਦੇ ਵਿਆਹਾਂ ਦੇ ਕਲਚਰ ਨੂੰ ਦੇਖੀਏ ਤਾਂ ਪਹਿਲਾਂ ਬੜਾ ਸਿੱਧਾ ਸਾਧਾ ਸੀ ਜਿਹੜਾ ਸਾਰਾ ਅਤੇ ਲੋਕ ਗੀਤ ਗਾਏ ਜਾਂਦੇ ਅਤੇ ਉਹ ਲੋਕ ਗੀਤਾਂ 'ਤੇ ਲੋਕ ਨੱਚਦੇ ਅਤੇ ਥੋੜ੍ਹਾ ਬਹੁਤ ਖਾਂਦੇ ਪੀਂਦੇ ਅਤੇ ਮਿਲਦੇ ਲੋਕਾਂ ਨੂੰ ਹੱਸ ਖੇਡ ਕੇ ਅਤੇ ਉੱਥੇ ਨੱਚਣਾ ਗਾਣਾ ਕਰ ਲੈਂਦੇ ਆਪਣਾ ਨੱਚਣਾ ਟੱਪਣਾ ਪਰ ਜਿਵੇਂ ਅੱਜ ਆਪਾਂ ਆਧੁਨਿਕ ਹੋ ਗਏ ਜਿਵੇਂ ਆਪਣੇ ਕੋਲ ਸ ਸਾਧਨਾਂ ਦੀ ਥੋੜ੍ਹ ਨਹੀਂ ਰਹੀ ਜਦੋਂ ਹੁਣ ਸ ਸਾਧਨਾਂ ਦੀ ਬਥੇਰੀ ਆਪਣੇ ਕੋਲ ਥਾਂ ਹੈ ਅਤੇ ਹੁਣ ਸ਼ਾਦੀਆਂ 'ਤੇ ਵਿਆਹਾਂ ਵਿੱਚ ਅਖਾੜੇ ਲਗਾਉਣਾ ਅਤੇ ਡੀ ਜੇ ਲਗਾਉਣਾ ਅਤੇ ਸਾਰੀ ਸਾਰੀ ਰਾਤ ਡੀ ਜੇ ਚੱਲ ਜਾਣਾ ਇੱਕ ਬੜਾ ਹੀ ਆਮ ਜਿਹੀ ਗੱਲ ਹੈ ਕਿਉਂਕਿ ਲੋਕ ਆਪਣੇ ਸਾਰੇ ਕੰਮ ਕਾਰ ਨੂੰ ਛੱਡ ਕੇ ਇੱਕ ਦਿਨ ਜਾਂ ਦੋ ਦਿਨ ਉਹ ਜਿਹੜਾ ਆਨੰਦ ਮਾਣਨਾ ਚਾਹੁੰਦੇ ਆ ਜੋ ਵੀ ਕੁਝ ਕਰਨਾ ਚਾਹੁੰਦੇ ਆ ਉਹ ਕਹਿਣ ਵਾਸਤੇ ਆਉਂਦੇ ਆ

ਵਿਆਹਾਂ ਵਿੱਚ ਆਨੰਦ ਮਾਣਨ ਵਾਸਤੇ ਜੇ ਮੈਂ ਆਪ ਦਾ ਜ਼ਿਕਰ ਕਰਾਂ ਤਾਂ ਮੈਂ ਅਜੇ ਵੀ ਕਈ ਵਾਰ ਬਜ਼ੁਰਗਾਂ ਨਾਲ ਬਹਿਨਾ ਲੋਕਾਂ ਨਾਲ ਮਿਲਦਾ ਹਾਂ ਕਈ ਤਰੀਕੇ ਦੀ ਜਿਹੜੀ ਭੋਜ ਹੈ ਜਾਂ ਵਿਅੰਜਨ ਹੈ ਜਿਹੜਾ ਖਾਣ ਦਾ ਜਿਹੜੀ ਡਿਸ਼ ਹੈ ਡੈਲੀਕੇਸੀ ਉਹ ਟਰਾਈ ਕਰਦਾ ਅਤੇ ਜੇ ਗਾਣਿਆ ਦੀ ਗੱਲ ਕਰੀਏ ਤਾਂ ਮੈਂ ਅੱਜੇ ਵੀ ਪੁਰਾਣੇ ਭਗਵੰਤ ਮਾਨ ਦੇ ਗਾਣੇ ਕੁਲਦੀਪ ਮਾਣਕ ਇਹੋ ਜਿਹੇ ਜਿਹੜੇ ਬਹੁਤ ਪੁਰਾਣੇ ਸਿੰਗਰ ਆ ਉਹਨਾਂ ਦੇ ਗਾਣੇ ਹਾਲੇ ਵੀ ਸੁਣਦਾ ਪਰ ਕੁਛ ਮੌਰਡਨਾਜੇਸ਼ਨ ਕਰਕੇ ਕੁਝ ਇਹੋ ਜਿਹੇ ਵੀ ਲੈ ਫਾਂ ਵਾਲੇ ਗਾਣੇ ਚੱਲਣ ਲੱਗ ਗਏ ਜਿਹਨਾਂ ਵਿੱਚ ਜਿਹੜੇ ਆਪਣੇ ਆਤਮਿਕਤਾ ਜਿਹੜੇ ਪੰਜਾਬ ਦੀ ਆਤਮਿਕ ਆ ਉਹਨੂੰ ਦਰਸਾਉਂਦੇ ਨੇ ਅਤੇ ਉਹ ਸ਼ੂ ਅਤੇ ਸ਼ਾਂ ਅਤੇ ਸ਼ੋਰ ਸ਼ਰਾਬਾ ਅਤੇ ਸੰਗੀਤ ਨਾ ਹੋ ਕੇ ਅਤੇ ਉਹ ਸ਼ੌਰ ਸ਼ਰਾਬਾ ਹੈ ਮੈਂ ਹਾਲੇ ਵੀ ਪੁਰਾਣੇ ਤਰੀਕੇ ਨਾਲ ਸੱਭਿਆਚਾਰਕ ਜਿਹੜੇ ਗਾਣੇ ਆ ਆਪਣੇ ਪੰਜਾਬੀ ਇਤਿਹਾਸ ਨੂੰ ਦਰਸਾਉਂਦੇ ਆ ਉਹਨਾਂ ਨੂੰ ਸੁਣਨਾ ਪਸੰਦ ਕਰਦਾ ਹਾਂ ਅਤੇ ਇਸ ਤਰੀਕੇ ਨਾਲ ਮੈਂ ਅ ਵਿਆਹ ਵਿੱਚ ਆਨੰਦ ਮਾਣਦਾ